ਹੈਲੋ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਕੀ ਹਾਲ ਚਾਲ ਹੈ ਜੀ ਅੱਛਾ ਭਾਅ ਜੀ ਮੈਂ ਨਾ ਤੁਹਾਡੇ ਸ਼ਹਿਰ ਆਇਆ ਸੀ ਮੈਂ ਪਤਾ ਕਰਨਾ ਸੀ ਭਾਅ ਜੀ ਤੁਹਾਡੇ ਸ਼ਹਿਰ ਦੇ ਵਿੱਚ ਫਾਸਟ ਫੂਡ ਮਠਿਆਈਆਂ ਚਾਈਨੀਜ਼ ਖਾਣਾ ਜਾਂ ਘਰ ਵਰਗਾ ਜਿਹੜਾ ਖਾਣਾ ਏ ਉਹ ਭਾਅ ਜੀ ਕਿਹ ਤੋਂ ਵਧੀਆ ਮਿਲੇਗਾ ਆਪਾਂ ਨੂੰ ਇਹ ਪਤਾ ਕਰਨਾ ਸੀਗਾ ਮੈਂ ਤੁਹਾਤੋਂ ਕਿਰਪਾ ਕਰਕੇ ਮੈਨੂੰ ਦੱਸਿਓ ਹੈ ਨਾ ਕਿ ਜਿਹਦੀ ਹੋਮ ਡਿਲੀਵਰੀ ਵੀ ਹੋ ਜਾਵੇ ਅਤੇ ਆਪਾਂ ਨੂੰ ਕਿਤੇ ਜਾਣਾ ਵੀ ਨਾ ਪਵੇ ਇਹਦੇ ਬਾਰੇ ਜ਼ਰੂਰ ਦੱਸਿਓ ਮੈਨੂੰ ਥੈਂਕ ਯੂ